ਹੈਲੋ ਹਾਂ ਮੈਂ ਠੀਕ ਅਮਨ ਤੂੰ ਦੱਸ ਹੋਰ ਕੀ ਬਣਦਾ ਜੁੜਦਾ ਲਾ ਲਿਆ ਪਾਣੀ ਠੀਕ ਹੈ ਠੀਕ ਹੈ ਆਪਣੇ ਵੀ ਬਸ ਇਹੀ ਕੁਛ ਚੱਲੀ ਜਾਂਦਾ ਠੀਕ ਹੈ ਕੱਲ੍ਹ ਪਿੰਡ 'ਚ ਕੀ ਹੋਇਆ ਸੀ ਕੀ ਅੱਛਾ ਅੱਛਾ ਅੱਛਾ ਅੱਛਾ ਅੱਛਾ ਅੱਛਾ ਕੀ ਕਹਿੰਦੇ ਸੀ ਫਿਰ ਖੇਤੀ ਅਫ਼ਸਰ ਹਮ ਹਮ ਹਮ ਹਮ ਅੱਛਾ ਅੱਛਾ ਵੀ ਕੀ ਕੀ ਫ਼ਸਲਾਂ ਦੇ ਉੱਪਰ ਅਸਰ ਹੋਈ ਜਾਂਦਾ ਉਹ ਪਿੱਛੇ ਪਹਿਲਾਂ ਵੀ ਆਏ ਸੀ ਇੱਕ ਵਾਰੀ ਹੈ ਨਾ ਆਪਣੇ ਪਿੰਡ ਹਾਂ ਹਾਂ ਉਹ ਫਸ ਹਾਂ ਹਾਂ ਉਹ ਹੀ ਗਰਮੀ ਗਰਮੀ ਹੋਈ ਜਾਂਦੀ ਆ ਸਰਦੀ ਹੈ ਤਾਂ ਸਰਦੀ ਹੋਈ ਜਾਂਦੀ ਆ ਝਾੜ ਘਟੀ ਜਾਂਦੇ ਆ ਹਾਂ ਹੋਰ ਕੋਈ ਹੱਲ ਨਹੀਂ ਦੱਸ ਕੇ ਗਏ ਬਸ ਕਿ ਇਕੱਲਾ ਲੈਕਚਰ ਹੀ ਦੇ ਕੇ ਗਏ ਆ ਹਮ ਹਮ ਹਾਂ ਹਾਂ ਹਾਂ ਮੈਨੂੰ ਦੱਸ ਦੇ ਤਾਂ ਪਏ ਸੀਗੇ ਘਰ ਦੇ ਕਹਿੰਦੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਆਏ ਨੇ ਆਪਣੇ ਪਿੰਡ 'ਚ ਅਤੇ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਹੁਣ ਉਹ ਦੱਸ ਰਹੇ ਹੈ ਲੋਕਾਂ ਨੂੰ ਆਰਗੈਨਿਕ ਤਾਂ ਹਾਂ ਕਰੀਏ ਤਾਂ ਸਹੀ ਪਰ ਫਿਰ ਉਹ ਹੀ ਆ ਨਾ ਵੀ ਹਰ ਇੱਕ ਬੰਦਾ ਆਪਣਾ ਫਾਇਦਾ ਸੋਚਦਾ ਕਾਹਨੂੰ ਕੋਈ ਔਰਗੈਨਿਕ ਕਰਦਾ ਕਿਹਨੂੰ ਹੈਗਾ ਹੈ ਨਾ ਵੀ ਮੈਂ ਝਾੜ ਸਪੈਸ ਸਪੈਸੀਫਿਕ ਹੀ ਕਰਾਂ ਉਸ ਚੀਜ਼ ਨੂੰ ਲੈ ਕੇ ਹੈ ਨਾ ਹਮ ਹਮ ਬਸ ਮੈਂ ਇਹ ਹੀ ਪੁੱਛਣਾ ਸੀਗਾ ਹੈ ਨਾ ਬਾਕੀ ਸ਼ਾਮ ਨੂੰ ਠੀਕ ਹਾਂ ਹਾਂ ਠੀਕ ਆ ਚਲ ਸ਼ਾਮ ਨੂੰ ਓਕੇ ਓਕੇ ਓਕੇ